ਹੈਲੋ ਹਾਂਜੀ ਹਾਂਜੀ ਅਮਨ ਗੱਲ ਕਰ ਰਹੀ ਹਾਂ ਜੀ ਅੱਛਾ ਜੀ ਅੱਛਾ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਤੁਸੀਂ ਸਾਡੇ ਗਵਾਂਢ 'ਚ ਨਵੇਂ ਆਏ ਹੋ ਮੈਨੂੰ ਪਤਾ ਲੱਗਿਆ ਸੀ ਹਾਂਜੀ ਹਾਂਜੀ ਹਾਂਜੀ ਤਾਜ਼ੀ ਸਬਜ਼ੀਆਂ ਜੀ ਅੱਛਾ ਜੀ ਠੀਕ ਹੈ ਠੀਕ ਹੈ ਨਹੀਂ ਕੋਈ ਗੱਲ ਨਹੀਂ ਜੀ ਜ਼ਰੂਰ ਜੀ ਆਪਾਂ ਜਿਹੜੇ ਤੁਸੀਂ ਸਬਜ਼ੀ ਦੀ ਗੱਲ ਕਰ ਰਹੇ ਹੋ ਨਾ ਸਬਜ਼ੀ ਆਪਣੇ ਸ਼ਹਿਰ 'ਚ ਵੱਡੀ ਮੰਡੀ ਲੱਗਦੀ ਹੈ ਇੱਕ ਉਹ ਡੇਲੀ ਓਪਨ ਹੁੰਦੀ ਹੈ ਸਵੇਰੇ ਜਲ ਅਰ ਅਰਲੀ ਹੋ ਜਾਂਦੀ ਹੈ ਅਤੇ ਉਸ ਤੋਂ ਤਾਂ ਫਰੈੱਸ਼ ਸਬਜ਼ੀ ਮਿਲ ਜਾਂਦੀ ਡੇਲੀ ਦੀ ਡੇਲੀ ਉੱਥੇ ਫਰੈੱਸ਼ ਹੀ ਆਉਂਦੀ ਹੈ ਅਤੇ ਅਸੀਂ ਵੀ ਉੱਥੋਂ ਹੀ ਲੈ ਕੇ ਆਉਂਦੇ ਆ ਵੈਸੇ ਅਤੇ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਹਾਂਜੀ ਹਾਂਜੀ ਹਾਂਜੀ ਬਿਲਕੁਲ ਮੈਂ ਵੈਸੇ ਚੱਲ ਪਵਾਂਗੀ ਜੀ ਤੁਹਾਡੇ ਨਾਲ ਆਪਾਂ ਇਕੱਠੇ ਚੱਲ ਪਵਾਂਗੇ ਹੁਣ ਤਾਂ ਤੁਸੀਂ ਗਵਾਂਢੀ ਬਣ ਗਏ ਹੋ ਤੁਸੀਂ ਬੇਫ਼ਿਕਰ ਰਹਿਓ ਜਦੋਂ ਤੁਸੀਂ ਜਾਣਾ ਹੋਇਆ ਮੈਨੂੰ ਦੱਸ ਦਿਓ ਆਪਾਂ ਚੱਲ ਪਵਾਂਗੇ ਇਕੱਠੇ ਨਾਲੇ ਇੱਕ ਵਾਰ ਮਿਲ ਮਿਲ ਮੇਲ ਮਿਲਾਪ ਹੋ ਜੇਗਾ ਨਾਲੇ ਜਾਣ ਪਹਿਚਾਣ ਹੋ ਜੇਗੀ ਅਤੇ ਇੱਕ ਵਾਰ ਜਾਏ ਆਵਾਂਗੇ ਮੰਡੀ ਮੈਂ ਤੁਹਾਨੂੰ ਖੁਦ ਹੀ ਦਿਖਾਏ ਆਵਾਂਗੀ ਨਾਲੇ ਥੋੜ੍ਹਾ ਬਹੁਤਾ ਤੁਹਾਨੂੰ ਮੈਂ ਇਹ ਵੀ ਦੱਸ ਦੂੰਗੀ ਨਾ ਕਿਤੇ ਥੋੜ੍ਹਾ ਬਹੁਤਾ ਜਿੱਥੇ ਰੇਟ ਰੂਟ ਦਾ ਵੀ ਫਰਕ ਹੈਗਾ ਮੰਡੀ ਦੇ ਵਿੱਚ ਠੀਕ ਹੈ ਹੁਣ ਤਾਂ ਤੁਸੀਂ ਸਾਡੇ ਗਵਾਂਢੀ ਹੋ ਗਏ ਇੰਨੇ ਤਾਂ ਸਾਡਾ ਫਰਜ਼ ਬਣਦਾ ਹੀ ਹੈ ਅਤੇ ਬਾਕੀ ਤੁਸੀਂ ਚੱਲ ਪਿਓ ਮੇਰੇ ਨਾਲ ਜ ਜਦੋਂ ਕਹੋਂਗੇ ਨਹੀਂ ਨਹੀਂ ਜ਼ਿਆਦਾ ਦੂਰ ਨਹੀਂ ਹੈ ਜੀ ਬਸ ਆਪਣਾ ਆਹੀ ਪੰਜ ਛੇ ਸੌ ਮੀਟਰ 'ਤੇ ਪੈਣੀ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਆਪਾਂ ਪੈਦਲ ਹੀ ਚੱਲ ਪਵਾਂਗੇ ਠੀਕ ਹੈ ਜੀ ਤੁਸੀਂ ਦੱਸ ਦਿਉ ਜਦੋਂ ਤੁਸੀਂ ਕਹੋਗੇ ਅੱਜ ਸ਼ਾਮੀ ਚੱਲਦੇ ਹਾਂ ਜੇ ਅੱਜ ਸ਼ਾਮੀ ਕਹੋ ਕੱਲ ਮੋਰਨਿੰਗ ਜਾਣਾ ਕੱਲ ਮੋਰਨਿੰਗ ਚਲਦੇ ਜਿਵੇਂ ਤੁਹਾਨੂੰ ਠੀਕ ਲੱਗਦਾ ਕੋਈ ਗੱਲ ਨਹੀਂ ਜੀ ਹੋਰ ਸੇਵਾ ਦੱਸੋ ਜੀ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਠੀਕ ਓਕੇ ਜੀ ਧੰਨਵਾਦ